ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਰਾਜਨੀਤੀ ਅਤੇ ਸਿਆਸੀ ਪਾਰਟੀਆਂ ਬਾਰੇ ਕੀ ਸੋਚਦਾ ਹਾਂ ਮੇਰੇ ਸੋਚ ਨਾਲ ਮੈਨੂੰ ਇਹ ਲੱਗਦਾ ਹੈ ਕਿ ਭਾਰਤ ਦੀ ਰਾਜਨੀਤੀ ਅਤੇ ਸਿਆਸੀ ਪਾਰਟੀਆਂ ਲੋਕਾਂ ਲਈ ਬਹੁਤ ਹੀ ਮਦਦਗਾਰ ਹਨ ਲੋਕਾਂ ਨੂੰ ਬਹੁਤ ਮਦਦ ਕਰਦੀਆਂ ਹਨ ਲੋਕਾਂ ਨਾਲ ਖੜ੍ਹਦੀਆਂ ਹਨ ਅਤੇ ਜਿ ਜਿਨ੍ਹਾਂ ਲੋਕਾਂ ਕਾਰਨ ਇਹ ਖੜ੍ਹੀਆਂ ਹੋਈਆਂ ਹਨ ਉਹਨਾਂ ਨੂੰ ਇਹ ਬਹੁਤ ਹੀ ਰਿਸਪੈਕਟ ਕਰਦੀਆਂ ਹਨ ਭਾਰਤ ਦੇ ਲੋਕਤੰਤਰ ਵਿੱਚ ਮੈਨੂੰ ਇਹ ਚੀਜ਼ ਪਸੰਦ ਹੈ ਕਿ ਇਹ ਜਨਤਾ ਨਾਲ ਖੜ੍ਹਦੇ ਹਨ ਉਹਨਾਂ ਦੀ ਹਰ ਇੱਕ ਮੁਸੀਬਤ ਵਿੱਚ ਮਦਦ ਕਰਦੇ ਹਨ ਕਿ ਕਈ ਥਾਵਾਂ ਉੱਤੇ ਜਿਵੇਂ ਹੜ੍ਹ ਆ ਜਾਂਦੇ ਹਨ ਤਾਂ ਭਾਰਤ ਸਰਕਾਰ ਦੀਆਂ ਪਾਰਟੀਆਂ ਹੀ ਉਹਨਾਂ ਨੂੰ ਉਸ ਥਾਂ ਉੱਤੋਂ ਲੈ ਜਾਣ ਵਿੱਚ ਮਦਦ ਕਰਦੀਆਂ ਹਨ ਉਹਨਾਂ ਨੂੰ ਸਹੀ ਚੀਜ਼ ਪਹੁੰਚਾਉਣ ਵਿੱਚ ਮਦਦ ਕਰਦੀਆਂ ਹਨ ਅਤੇ ਉਹਨਾਂ ਨੂੰ ਸੁਰੱਖਿਅਤ ਰੱਖਦੀਆਂ ਹਨ ਪਰ ਇੱਕ ਚੀਜ਼ ਹੈ ਜੋ ਕਿ ਮੈਨੂੰ ਨਾਪਸੰਦ ਹੈ ਉਹ ਹੈ ਕਿ ਕਈ ਬੰਦੇ ਪਾਰਟੀਆਂ ਵਿੱਚ ਭ੍ਰਿਸ਼ਟ ਹੁੰਦੇ ਹਨ ਉਹ ਲ ਲੋਕਾਂ ਤੋਂ ਕੋਲੋਂ ਰਿਸ਼ਵਤ ਲੈਂਦੇ ਹਨ ਅਤੇ ਉਹਨਾਂ ਕਰਕੇ ਹੀ ਪਾਰਟੀ ਦਾ ਨਾਮ ਵੀ ਖਰਾਬ ਹੁੰਦਾ ਹੈ ਮੇਰਾ ਪਸੰਦੀਦਾ ਰਾਜਨੀਤਿਕ ਨੇਤਾ ਨਰਿੰਦਰ ਮੋਦੀ ਹੈ ਜੋ ਕਿ ਭਾਰਤ ਦਾ ਪ੍ਰਧਾਨ ਮੰਤਰੀ ਵੀ ਹੈ ਜੇਕਰ ਮੈਂ ਉਸਨੂੰ ਮਿਲਾਂਗਾ ਤਾਂ ਮੈਂ ਉਸ ਉਹਨਾਂ ਨੂੰ ਪੁੱਛਾਂਗਾ ਕਿ ਤੁਸੀਂ ਭਾਰਤ ਦੇਸ਼ ਕਿਵੇਂ ਹੈਂਡਲ ਕਰਦੇ ਹੋ ਅਤੇ ਮੈਂ ਉਹਨਾਂ ਦਾ ਸੁਝਾਅ ਸੁਣ ਕੇ ਉਹਨਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਭਾਰਤ ਵਿੱਚ ਲੋਕਾਂ ਦੇ ਲੈਵਲ 'ਤੇ ਥੋੜ੍ਹੀ ਬਹੁਤੀਆਂ ਮੁਸੀਬਤਾਂ ਹਨ ਤਾਂ ਜੋ ਉਹ ਆਪਣਾ ਯੋਗਦਾਨ ਦੇ ਕੇ ਇਹਨਾਂ ਨੂੰ ਵੀ ਹੱਲ ਕਰਨ ਧੰਨਵਾਦ